ਹਰ ਇੱਕ ਨੂੰ ਕੋਈ ਨਾ ਕੋਈ ਮਤਲਵ ਕਿ ਕਿਸੇ ਨਾ ਕਿਸੇ ਚੀਜ਼ 'ਚ ਰੁਚੀ ਹੁੰਦੀ ਹੈ ਅਤੇ ਮਤਲਬ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਹੈ ਤਾਂ ਮੈਨੂੰ ਪੁਰਾਣੇ ਨੋਟਾਂ ਦਾ ਮਤਲਵ ਜੋ ਕਿ ਅਠਾਰ੍ਹਾਂ ਸੌ ਤੋਂ ਮੈਨੂੰ ਉਹਨਾਂ ਨੋਟਾਂ ਨੂੰ ਇਕੱਠੇ ਕਰਨ ਦਾ ਬਹੁਤ ਸ਼ੌਂਕ ਸੀ ਮੈਂ ਹਰ ਜਗ੍ਹਾ 'ਤੇ ਜਾ ਜਾ ਕੇ ਮਤਲਬ ਪੁਰਾਣੀ ਕਰੰਸੀ ਜਿੰਨੀਆਂ ਵੀ ਪੁਰਾਣੀ ਕਰੰਸੀ ਹੁੰਦੀ ਆ ਸਾਰਿਆਂ ਨੂੰ ਮਤਲਬ ਮੈਂ ਆਪਣੇ ਉਹ ਇਕੱਠੀ ਕਰਕੇ ਮਤਲਬ ਹਰ ਜਗ੍ਹਾ ਜਗ੍ਹਾ 'ਤੇ ਜਾ ਕੇ ਮੈਂ ਉਹ ਪੁਰਾਣੀ ਕਰੰਸੀ ਮਤਲਬ ਇਕੱਠੀ ਕੀਤੀ ਮੈਂ ਮਤਲਬ ਕਿ ਕਾਫ਼ੀ ਜ਼ਿਆਦਾ ਨੋਟ ਆਪਣੇ ਕੋਲ ਮਤਲਬ ਇਕੱਠੇ ਕਰ ਲਏ ਮਤਲਬ ਕਿ ਇੰਨਾ ਕੁ ਸ਼ੌਂਕ ਸੀ ਜਗ੍ਹਾ ਜਗ੍ਹਾ 'ਤੇ ਜਾ ਕੇ ਹਰ ਇੱਕ ਨਵੇਂ ਨਵੇਂ ਤੋਂ ਨਵੇਂ ਬੰਦਿਆਂ ਨਾ ਮਿਲ ਕੇ ਮੈਂ ਉਹ ਨੋ ਨੋਟ ਇਕੱਠੇ ਕੀਤੇ ਅਤੇ ਲੇਕਿਨ ਇਕ ਹਰ ਇੱਕ ਨੂੰ ਕੋਈ ਨਾ ਕੋਈ ਮੁਸ਼ਕਿਲ ਆ ਜਾਂਦੀ ਹੈ ਪਰ ਇੱਕ ਟਾਇਮ ਇੱਦਾਂ ਦਾ ਆਇਆ ਜਦੋਂ ਕਿ ਮੇਰੇ ਵਪਾਰ ਦੇ ਵਿੱਚ ਕਾਫ਼ੀ ਘਾਟਾ ਪੈ ਗਿਆ ਅਤੇ ਮੈਨੂੰ ਉਹ ਨੋਟਾਂ ਨੂੰ ਮਤਲਬ ਕਿ ਦੇ ਕੁਝ ਨੋਟਾਂ ਨੂੰ ਸਾਰੇ ਤਾਂ ਨਹੀਂ ਨੋਟ ਕੁਛ ਨੋਟ ਮੈਂ ਉਹ ਦੇ ਦਿੱਤੇ ਅਤੇ ਮਤਲਬ ਕਿ ਫਿਰ ਮੈਨੂੰ ਮਤਲਬ ਬਹੁਤ ਮੈਂ ਦਿਲ 'ਚ ਪੱਥਰ ਰੱਖ ਕੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਮੈਂ ਬੜੀ ਮੁਸ਼ਕਿਲਾਂ ਦੇ ਨਾਲ ਉਹ ਇਕੱਠੇ ਪੈਸੇ ਇਕੱਠੇ ਕੀਤੇ ਸੀ ਅਤੇ ਮੈਨੂੰ ਉਹ ਮਤਲਬ ਕਿ ਮੈਂ ਉਹ ਨੋਟ ਫਿਰ ਦਿੱਤੇ ਅਤੇ ਮਤਲਬ ਫਿਰ ਪਰਮਾਤਮਾ ਦੀ ਇਸ ਤਰ੍ਹਾਂ ਦੀ ਕਿਰਪਾ ਹੋਈ ਕਿ ਮੇਰਾ ਮਤਲਬ ਫਿਰ ਵਪਾਰ ਦੇ ਵਿੱਚ ਕਾਫ਼ੀ ਮੈਨੂੰ ਲਾਭ ਮਿਲਿਆ ਮਤਲਬ ਕਾਫ਼ੀ ਮੇਰਾ ਬਿਜਨਸ ਹੋਰ ਵੱਧ ਗਿਆ ਅਤੇ ਫਿਰ ਮੈਂ ਉਹ ਹੀ ਮੈਂ ਫਿਰ ਇਹ ਹੀ ਸੋਚਿਆ ਕਿ ਮੈਂ ਆਪਣੇ ਜਿਹੜੇ ਮੈਂ ਆਪਣੇ ਨੋਟ ਦਿੱਤੇ ਹੱਥ ਉਹਨਾਂ ਨੂੰ ਮੈਂ ਦੁਬਾਰਾ ਤੋਂ ਫਿਰ ਇਕੱਠੇ ਕਰਾਂਗੀ ਫਿਰ ਮੈਂ ਇਸ ਵਾਰ ਹਰ ਜਗ੍ਹਾ 'ਤੇ ਜਾ ਜਾ ਕੇ ਮੈਂ ਉਹਨਾਂ ਨੋਟਾਂ ਨੂੰ ਇਕੱਠਾ ਕੀਤਾ ਅਤੇ ਆਪਣੇ ਕੋਲ ਫਿਰ ਉਹਨਾਂ ਨੂੰ ਨੋਟਾਂ ਨੂੰ ਮੈਂ ਸਾਰਿਆਂ ਨੂੰ ਆਪਣਿਆਂ ਨੂੰ ਸੰਭਾਲ ਕੇ ਰੱਖਿਆ ਕਿਉਂਕਿ ਉਹਨਾਂ ਨੂੰ ਮੈਂ ਆਪਣੇ ਬੱਚਿਆਂ ਵਾਂਗ ਹੀ ਨੋਟਾਂ ਨੂੰ ਪਿਆਰ ਕਰਦੀ ਸੀ ਅਸੀਂ ਇਹ ਨਹੀਂ ਹੈਗਾ ਕਿ ਮੈਨੂੰ ਇਹ ਪੇ ਮੇਰੇ ਵਾਸਤੇ ਪੈਸਾ ਹੀ ਸਭ ਕੁਝ ਹੈ ਲੇਕਿਨ ਇੱਕ ਪਾਸੇ ਇੱਕ ਸ਼ੌਂਕ ਹੋ ਜਾਂਦਾ ਹੈ ਸ਼ੌਂਕ ਦੇ ਤੌਰ 'ਤੇ ਮੈਂ ਉਨ੍ਹਾਂ ਪੈਸਿਆਂ ਨੂੰ ਇਕੱਠਾ ਕੀਤਾ